ਅਗਰ ਮੇਰੇ ਤੋਂ ਕੋਈ ਰੈਸੀਪੀ ਖ਼ਰਾਬ ਵੀ ਹੋ ਜਾਂਦੀ ਹੈ ਤਾਂ ਮੈਂ ਆਪਣੀ ਮਾਤਾ ਜੀ ਦੀ ਮਦਦ ਨੀ ਨਾਲ਼ ਮਦਦ ਦੇ ਨਾਲ਼ ਉਸ ਰੈਸੀਪੀ ਨੂੰ ਠੀਕ ਕਰਨ ਦਾ ਪੂਰਾ ਯਤਨ ਕਰਾਂਗੀ